ਮੈਨੂੰ ਹਾਸੇ ਵਾਲੀਆਂ ਫਿਲਮਾਂ ਜ਼ਿਆਦਾ ਪਸੰਦ ਹਨ ਅਤੇ ਸੱਭਿਆਚਾਰਕ ਕਿਉਂਕਿ ਮੈਂ ਮੈਂ ਸੱਭਿਆਚਾਰ ਨਾਲ ਬਹੁਤ ਜ਼ਿਆਦਾ ਜੁੜੀ ਹਾਂ ਇਸ ਕਰਕੇ ਮੈਨੂੰ ਪਰਿਵਾਰਿਕ ਫਿਲਮਾਂ ਦੇਖਣਾ ਬਹੁਤ ਪਸੰਦ ਹਨ ਜਿਵੇਂ ਕਿ ਰੱਬ ਦਾ ਰੇਡੀਓ ਵੱਨ ਅਤੇ ਟੂ ਇਹਦੇ ਵਿੱਚ ਸਾਰੇ ਪਰਿਵਾਰਿਕ ਜੋ ਕਿ ਇੱਕ ਪਰਿਵਾਰਿਕ ਫਿਲਮ ਹੈ ਅਤੇ ਇਹਦੇ ਵਿੱਚ ਸਾਰੇ ਪਰਿਵਾਰਿਕ ਰਿਸ਼ਤੇ ਕਿਵੇਂ ਵਰਤ ਕਿਵੇਂ ਨਿਭਾਉਣੇ ਹਨ ਦੱਸੇ ਜਾਂਦੇ ਹਨ